ਹੈਲੋ ਸਤਿ ਸ਼੍ਰੀ ਅਕਾਲ ਜੀ ਰਿਵਾਜ ਹੈਂਡ ਵ ਤੋਂ ਗੱਲ ਕਰ ਰਹੇ ਹੋ ਭਾਅ ਜੀ ਇੱਕ ਬੈਗ ਆਪਾਂ ਲਾਸਟ ਵੀਕ ਕਰਵਾਇਆ ਸੀ ਔਡਰ ਕਰਵਾਇਆ ਸੀ ਹਾਂਜੀ ਗੂੱਚੀ ਦਾ ਇਹਦੇ ਵਿੱਚ ਉਹ ਮੈਨੂੰ ਮਿਲ ਗਿਆ ਹੈ ਨਹੀਂ ਨਹੀਂ ਮਿਲ ਗਿਆ ਹੈ ਮੈਨੂੰ ਟਾਈਮ ਨਾਲ ਮਿਲ ਗਿਆ ਹੈ ਅਤੇ ਬਸ ਮੈਂ ਉਹਦਾ ਫੀਡਬੈਕ ਹੀ ਦੇਣਾ ਸੀ ਬਹੁਤ ਅੱਛਾ ਬੈਗ ਹੈ ਤੁਹਾਡਾ ਬਿਲਕੁਲ ਕੋਆਲੀਟੀ ਵਾਈਜ਼ ਜੋ ਵੀ ਤੁਸੀਂ ਔਨਲਾਈਨ ਤੁਸੀਂ ਪਿਕਸ ਪਾਈਆਂ ਹੋਈਆਂ ਸੀ ਸੇਮ ਟੂ ਸੇਮ ਹੈ ਅਤੇ ਨਾਲ ਉਹਦੀ ਜੋ ਵੀ ਉਹਦੀ ਮਤਲਬ ਕਲਰ ਹੈ ਕਲਰ ਬਹੁਤ ਵੀ ਅੱਛਾ ਹੈ ਅਤੇ ਇਹ ਕਲਰ ਮੈਨੂੰ ਮਾਰਕਿਟ 'ਚੋਂ ਮਿਲ ਵੀ ਨਹੀਂ ਰਿਹਾ ਸੀ ਜਿਹੜਾ ਤੁਹਾਡੇ ਕੋਲੋਂ ਮੈਨੂੰ ਔਨਲਾਈਨ ਅਵੇਲੇਵਲ ਹੋ ਗਿਆ ਹੈ ਅਤੇ ਨਾਲ ਹੀ ਇਹਦੀ ਜਿੱਪਸ ਵਗੈਰਾ ਜਿਹੜੀਆਂ ਸਾਰੀ ਮਤਲਬ ਕੋਆਲੀਟੀ ਬੈਗ ਦੀ ਜਿਹੜੀ ਮਟੀਰੀਅਲ ਜੋ ਵੀ ਉਹਦੇ ਵਿੱਚ ਲੱਗਿਆ ਹੋਇਆ ਇੰਨਰ ਔਰ ਆਊਟ ਸਾਈਡ ਦੋਨੋਂ ਸਾਈਡ ਤੋਂ ਵਧੀਆ ਲੱਗਿਆ ਹੋਇਆ ਹੈ ਅਤੇ ਇੱਕ ਸਭ ਤੋਂ ਬੈਸਟ ਚੀਜ਼ ਇਹ ਹੈ ਕਿ ਜੋ ਜਿਹੜੀਆਂ ਤੁਸੀਂ ਸਲਿੰਗ ਇੱਕ ਤਾਂ ਹੈ ਹੀ ਸੀ ਇੱਕ ਇਹਦੇ ਨਾਲ ਬੈਲਟ ਐਕਸਟ੍ਰਾ ਦਿੱਤੀ ਹੈ ਮੈਨੂੰ ਨਾ ਉਹ ਬਰੋਡਿਡ ਹੈ ਬਹੁਤ ਅੱਛੀ ਹੈ ਉਹ ਮੈਂ ਚਾਹੁੰਦੀ ਸੀ ਇਵੇਂ ਦੀ ਲੈਣੀ ਅਤੇ ਉਹ ਵੀ ਮਿਲ ਗਈ ਹੈ ਮੈਨੂੰ ਨਾਲ ਔਰ ਕਲਰ ਵਾਈਜ਼ ਬਹੁਤ ਵਧੀਆ ਹੈ ਅਤੇ ਜੋ ਚੀਜ਼ ਜੋ ਵੀ ਤੁਸੀਂ ਪਿੱਕ ਵਿੱਚ ਦਿਖਾਈ ਹੋਈ ਸੀ ਸੇਮ ਐਜ ਇੱਟ ਇਜ਼ ਹੀ ਮੈਂ ਰਸੀਵ ਕੀਤੀ ਹੈ ਕੋਈ ਵੀ ਡਿਫ਼ਰੈਂਸ ਨਹੀਂ ਲੱਗਿਆ ਅਤੇ ਇਸ ਲਈ ਤੁਹਾਡਾ ਬਸ ਧੰਨਵਾਦ ਕਰਨਾ ਸੀ ਥੈਂਕ ਯੂ ਸੋ ਮੱਚ ਹਾਂਜੀ ਧੰਨਵਾਦ ਜੀ